ਹੈਲੋ ਹਾਂਜੀ ਮੇਰਾ ਨਾਮ ਨੀਰੂ ਹੈ ਔਰ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅੱਜ ਮੈਂ ਮਤਲਬ ਕਿ ਮੈਂ ਪਸ਼ੂ ਪਾਲਣ ਵਿੱਚ ਜਾਨਵਰਾਂ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਗਰ ਕਿਸੇ ਜਾਨਵਰ ਨੂੰ ਕੋਈ ਵੀ ਬਿਮਾਰੀ ਲੱਗ ਜਾਂਦੀ ਹੈ ਜਿਵੇਂ ਕਿ ਮਤਲਬ ਕਿ ਪੈਰ ਅਤੇ ਮੂੰਹ ਦੀ ਬਿਮਾਰੀ ਐਬੀਅਨ ਇਨਫਲਿਊਜਐਜ਼ਾ ਆਦਿ ਔਰ ਜਦੋਂ ਵੀ ਕੋਈ ਵੀ ਬਿਮਾਰੀ ਇਸ ਤਰ੍ਹਾਂ ਦੀ ਜਾਨਵਰਾਂ ਨੂੰ ਹੋਏ ਤਾਂ ਮਤਲਬ ਕਿ ਸਾਨੂੰ ਸਭ ਤੋਂ ਪਹਿਲਾਂ ਮਤਲਬ ਕਿ ਉਹਨਾਂ ਦੇ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਜਾਨਵਰਾਂ ਦੇ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਜਿਸ ਕਰਕੇ ਸਾਨੂੰ ਜੋ ਵੀ ਮਤਲਬ ਕਿ ਡਾਕਟਰ ਉਹਨਾਂ ਦੇ ਟਰੀਟਮੈਂਟ ਵਾਸਤੇ ਕਹੇ ਸਾਨੂੰ ਉਹ ਕਰਨਾ ਚਾਹੀਦਾ ਜਿਸ ਤਰ੍ਹਾਂ ਮੂੰਹ ਦੀ ਬਿਮਾਰੀ ਹੋਵੇ ਮਤਲਬ ਅੱਛਾ ਖਾਦ ਮਤਲਬ ਕਿ ਵਗੈਰਾ ਉਹਨਾਂ ਨੂੰ ਸਾਨੂੰ ਪਾਉਣੀ ਬਹੁਤ ਜ਼ਰੂਰੀ ਹੈ ਔਰ ਜੋ ਅਸੀਂ ਘਾਹ ਪੂਸ ਪਾਉਂਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਕਿ ਉਹ ਬਿਲਕੁਲ ਸਾਫ ਸੁਥਰੀ ਹੈ ਕਿ ਨਹੀਂ ਹੈ ਜਿਸ ਕਰਕੇ ਮਤਲਬ ਕਿ ਉਹਨਾਂ ਦੇ ਮੂੰਹ ਵੀ ਖਰਾਬ ਹੋ ਸਕਦਾ ਹੈ ਜਦੋਂ ਪਸ਼ੂ ਜਾਨਵਰ ਕੁਛ ਵੀ ਖਾਂਦਾ ਹੈ ਉਹਦੀ ਦੇਖਭਾਲ ਕਰਨੀ ਸਾਡੀ ਜ਼ਿੰਮੇਵਾਰੀ ਹੈ ਔਰ ਅੱਛੇ ਤਰੀਕੇ ਦੇ ਨਾਲ ਮਤਲਬ ਕਿ ਸਾਨੂੰ ਉਹਦਾ ਟ੍ਰੀਟਮੈਂਟ ਕਰਨਾ ਚਾਹੀਦਾ ਹੈ ਅੱਛਾ ਘਾਹ ਗਾਸ ਖੁਆਉਣਾ ਚਾਹੀਦਾ ਹੈ ਅੱਛੀ ਖਾਦ ਹੁਣ ਤਾਂ ਹਰ ਕੁਛ ਉਹਨਾਂ ਨੂੰ ਅੱਛਾ ਹੀ ਦੇਣਾ ਜ਼ਰੂਰੀ ਹੈ ਜਿਸ ਕਰਕੇ ਮਤਲਬ ਕਿ ਅਸੀਂ ਉਹਨਾਂ ਬਿਮਾਰੀਆਂ ਨੂੰ ਬਚਾਅ ਸਕਦੇ ਹਾਂ ਉਹਨਾਂ ਨੂੰ ਮਦ ਅੱਛੇ ਟਾਈਮ 'ਤੇ ਮਤਲਬ ਕਿ ਸਾਫ ਸੁਥਰਾ ਸਾਨੂੰ ਰੱਖਣ ਦੀ ਬਹੁਤ ਜ਼ਿਆਦਾ ਨੋ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਮਤਲਬ ਵੀ ਉਹਨਾਂ 'ਤੇ ਕੋਈ ਕੁਛ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏ ਅਤੇ ਮਤਲਬ ਕਿ ਸਾਨੂੰ ਉਹਨਾਂ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਥੈਂਕ ਯੂ